ਹਾਂਜੀ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਭ ਅਤੇ ਹੋਰ ਪੰਜਾਬੀ ਸਮਕਾਲੀ ਲਹਿਰਾਂ ਕਿੰਨੀਆਂ ਸਨ ਜਿੰਨ੍ਹਾਂ ਦੀ ਸਾਡੇ ਪੰਜਾਬ ਦੇ ਉੱਤੇ ਬਹੁਤ ਹੀ ਇਫੈਕਟ ਪਏ ਹੈ ਮੀਨਜ਼ ਉੱਦੋਂ ਦੇ ਲਹਿਰਾਂ ਵਿੱਚ ਕਿੱਦਾਂ ਦੀ ਸੰਵੇਦਭਾਵਨਾ ਹੁੰਦੀਆਂ ਸਨ ਠੀਕ ਹੈ ਕਿੱਦਾਂ ਦਾ ਉਹ ਕਲਚਰ ਹੁੰਦਾ ਸੀ ਕਿੱਦਾਂ ਸਭ ਨੂੰ ਇੱਕ ਉਸ ਵਿੱਚ ਰੱਖਿਆ ਜਾਂਦਾ ਸੀ ਠੀਕ ਹੈ ਉਹਨਾਂ ਨੂੰ ਉੱਦਾਂ ਦੀ ਆਜ਼ਾਦੀ ਨਹੀਂ ਸੀਗੀ ਠੀਕ ਹੈ ਉਹਨਾਂ ਦੀ ਅਤੇ ਉੱਦਾਂ ਦੇ ਰੂਲ ਬਣਾਏ ਜਾਂਦੇ ਸੀ ਲੋਕਾਂ 'ਤੇ ਠੀਕ ਹੈ ਉਹਨਾਂ ਨੂੰ ਮੀਨਜ਼ ਉਹਨਾਂ ਲਹਿਰਾਂ ਨਾਲ ਵਿਸ਼ੇਸ਼ਤਾ ਵੀ ਸੀ ਠੀਕ ਹੈ ਪ੍ਰਭਾਵ ਵੀ ਬਹੁਤ ਪੈਂਦਾ ਸੀ ਉਹਨਾਂ ਲਹਿਰਾਂ ਦਾ ਉਹਨਾਂ ਉੱਤੇ ਠੀਕ ਹੈ ਜਿੰਨ੍ਹਾਂ ਕਰਕੇ ਬਹੁਤ ਹੀ ਜ਼ਿਆਦਾ ਮਾਹੌਲ ਵੀ ਖ਼ਰਾਬ ਹੋ ਜਾਂਦਾ ਸੀ ਪਰ ਕਈ ਜਗ੍ਹਾ 'ਤੇ ਮੀਨਜ਼ ਸੇਫਟੀ ਵੀ ਰਹਿੰਦੀ ਸੀ ਅਜ਼ਾਦੀ ਵੀ ਰਹਿੰਦੀ ਸੀ ਠੀਕ ਹੈ ਉਹਨਾਂ ਲਈ ਬਹੁਤ ਕੁਛ ਕੀਤਾ ਵੀ ਜਾਂਦਾ ਸੀ ਠੀਕ ਹੈ ਅਤੇ ਉਹਨਾਂ ਨੂੰ ਬਚਾਇਆ ਜਾਂਦਾ ਸੀ ਪਹਿਲਾਂ ਉਹਨਾਂ ਨੇ ਸਮਿਆਂ ਤੋਂ ਅਤੇ ਕਈ ਮੀਨਜ਼ ਆਪਣਾ ਅਜਿਹੀਆਂ ਸੀ ਜਿੰਨ੍ਹਾਂ ਨਾਲ ਦੁਨੀਆਂ ਤੋਂ ਬਹੁਤ ਇਫੈਕਟ ਪਿਆ ਉਹਨਾਂ ਨੂੰ ਉਹਦਾ ਨੁਕਸਾਨ ਬਹੁਤ ਕੁਛ ਸਹਿਣਾ ਪਿਆ ਹਾਂਜੀ